ਹੈਲੋ ਹਾਂਜੀ ਸਰ ਸੀਵੀਆਂ ਟਰੈਵਲ ਏਜੰਸੀ ਤੋਂ ਗੱਲ ਕਰ ਰਹੇ ਹਾਂ ਜੀ ਹਾਂਜੀ ਸਰ ਅਸੀਂ ਨਾ ਕਿਤੇ ਪ੍ਰੋਗਰਾਮ 'ਤੇ ਜਾਣ ਲਈ ਅਸੀਂ ਗੱਡੀ ਬੁੱਕ ਕਰਵਾਈ ਹੋਈ ਸੀ ਤੁਹਾਡੇ ਤੋਂ ਪਰ ਅਸੀਂ ਸੁਬਹਾ ਦੇ ਫੋਨ ਲਾ ਰਹੇ ਤੁਹਾਡਾ ਡਰਾਈਵਰ ਜਿਹੜਾ ਸਾਡਾ ਫੋਨ ਨਹੀਂ ਚੁੱਕ ਰਿਹਾ ਸੁਬਹਾ ਤੋਂ ਸਰ ਗੱਲ ਪਤਾ ਕੀ ਹੈ ਨਾ ਜੀ ਅਸੀਂ ਸਾਰੇ ਪਰਿਵਾਰ ਅਸੀਂ ਤਿਆਰ ਬੈਠੇ ਹਾਂ ਜੀ ਸੁਬਹਾ ਦੇ ਅਸੀਂ ਪ੍ਰੋਗਰਾਮ ਬਣਾਇਆ ਹੋਇਆ ਸੀ ਜਲਦੀ ਜਾਣ ਦਾ ਪਰ ਹੁਣ ਅਸੀਂ ਕਦੋਂ ਦੇ ਸੁਬਹਾ ਦੀ ਉਹਨੂੰ ਕਾਲ ਕਰ ਰਹੇ ਹਾਂ ਨਾ ਤਾਂ ਸਾਨੂੰ ਬੈਕ ਕਾਲ ਆਈ ਹੈ ਨਾ ਹੀ ਉਹਨੇ ਸਾਡਾ ਫੋਨ ਚੁੱਕਿਆ ਜੀ ਸੁਬਹਾ ਦਾ ਹਾਂਜੀ ਹੁਣ ਸਰ ਦੇਖੋ ਨਾ ਅਸੀਂ ਤਾਂ ਹੁਣ ਉਹਨਾਂ ਦੇ ਆਸਰੇ 'ਤੇ ਬੈਠੇ ਹਾਂ ਤੁਸੀਂ ਸਾਰੇ ਇੱਦਾਂ ਕਰੋ ਕਿ ਅਸੀਂ ਤੁਹਾਡੀ ਏਜੰਸੀ ਤੋਂ ਗੱਡੀ ਬੁੱਕ ਕਰਾਈ ਹੋਈ ਹੈ ਜਾਂ ਤਾਂ ਤੁਸੀਂ ਕੋਈ ਹੋਰ ਗੱਡੀ ਸਾਡੇ ਕੋਲ ਜਲਦੀ ਭੇਜੋ ਜਾਂ ਤੁਸੀਂ ਜੇਕਰ ਤੁਹਾਡੇ ਕੋਲ ਡਰਾਈਵਰ ਦਾ ਆਪਦੇ ਕੋਲ ਕੋਈ ਤੁਹਾਡਾ ਸੰਪਰਕ ਹੈਗਾ ਤਾਂ ਉਹਦੇ ਨਾਲ ਗੱਲ ਕਰਕੇ ਕਿਰਪਾ ਕਰਕੇ ਸਾਨੂੰ ਜਲਦੀ ਜਲਦੀ ਦੱਸੋ ਸਰ ਹਾਂਜੀ ਸਰ ਇੱਦਾਂ ਤਾਂ ਸਾਡਾ ਸਾਡਾ ਸਰ ਸਾਰਾ ਪ੍ਰੋਗਰਾਮ ਹੀ ਜਿਹੜਾ ਖਰਾਬ ਹੋ ਰਿਹਾ ਜੀ ਤੁਹਾਡੇ ਕਰਕੇ ਹਾਂਜੀ ਕਿਰਪਾ ਕਰਕੇ ਸਾਨੂੰ ਜਲਦੀ ਦੱਸੋ ਸਰ ਕੰਟੈਕਟ ਕਰਕੇ